ਹੈਲੋ ਸਰ ਓਲੇ ਤੋਂ ਬੋਲ ਰਹੇ ਹੋ ਮੈਂ ਮਤਲਬ ਕੈਬ ਬੁੱਕ ਕਰਵਾਈ ਸੀਗੀ ਫੈਮਲੀ ਦੇ ਨਾਲ ਜਾਣਾ ਸੀਗਾ ਅਤੇ ਡਰਾਈਵਿੰਗ ਨੂੰ ਟਾਈਮ ਦਿੱਤਾ ਸੀਗਾ ਦਸ ਵਜੇ ਦਾ ਜੋ ਕਿ ਡਰਾਈਵਰ ਦੇ ਲੇਟ ਆਉਣ ਕਾਰਣ ਅਤੇ ਸਾਡੇ ਕੋਲੋਂ ਨਹੀਂ ਜਾਇਆ ਗਿਆ ਜੋ ਕਿ ਅਸੀਂ ਸਾਰੇ ਦਿਨ ਵਿੱਚ ਵਾਪਿਸ ਵੀ ਆਉਣਾ ਸੀਗਾ ਅਤੇ ਗੱਡੀ ਨੰਬਰ ਹੈਗਾ ਵਾ ਵੀਹ ਸਤਾਈ ਅਤੇ ਹੁਣ ਮੈਂ ਇਹ ਜਿਹੜੀ ਕੈਪ ਆ ਉਹ ਕੈਂਸਲ ਕਰਵਾਉਣੀ ਆ ਅਤੇ ਇਹ ਮੇਰੀ ਜਿਹੜੀ ਕੈਪ ਆ ਇਹ ਕੈਂਸਲ ਕਰ ਦਿੱਤੀ ਜਾਵੇ ਫਿਰ ਅਸੀਂ ਕਿਤੇ ਫੈਮਿਲੀ ਦੇ ਨਾਲ ਜਾਵਾਂਗੇ ਫਿਰ ਅਸੀਂ ਤੁਹਾਡੀ ਇਹ ਕੈਪ ਬੁੱਕ ਕਰਵਾ ਲਾਂਗੇ